ਮੇਰਾ ਸਭ ਤੋਂ ਉੱਚਾ ਰਿਕਾਰਡ ਹੈ ਕਿ ਮੈਂ ਸੌ ਮੀਟਰ ਦੌੜ ਨੂੰ ਗਿਆਰਾਂ ਸਕਿੰਟ ਦੇ ਵਿੱਚ ਪੂਰਾ ਕੀਤਾ ਸੀ ਮੈਂ ਹਰ ਰੋਜ਼ ਗਰਾਊਂਡ ਦੇ ਵਿੱਚ ਇੱਕ ਘੰਟਾ ਭੱਜਣ ਦੀ ਪ੍ਰੈਕਟਿਸ ਕਰਦਾ ਹਾਂ ਅਤੇ ਪਰ ਸ਼ਾਮ ਨੂੰ ਵੀ ਇੱਕ ਘੰਟਾ ਭੱਜਣ ਦੀ ਪ੍ਰੈਕਟਿਸ ਕਰਦਾ ਹਾਂ ਮੇਰਾ ਟੀਚਾ ਹੈ ਕਿ ਮੈਂ ਵਰਲਡ ਰਿਕਾਰਡ ਨੌ ਸਕਿੰਟ ਨੂੰ ਤੋੜ ਕੇ ਆਪਣਾ ਇੱਕ ਨਵਾਂ ਇਕ ਨਵਾਂ ਵਰਲਡ ਰਿਕਾਰਡ ਸੈਟ ਕਰਾ ਤਾਂ ਜੋ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬੀ ਵੀ ਕਿਸੇ ਤੋਂ ਘੱਟ ਨਹੀਂ ਹਨ